ਪੁਰਾਣੇ ਸਮੇਂ ਤੋਂ ਲੈ ਕੇ ਹੁਣ ਸਮੇਂ ਤੱਕ ਡਾਕਟਰਾਂ ਅਤੇ ਹਸਪਤਾਲਾਂ ਦਾ ਸੁਧਾਰ ਬਹੁਤ ਵਧੀਆ ਹੋਇਆ ਹੈ ਹੁਣ ਹਰ ਹਸਪਤਾਲ ਵਿੱਚ ਤੁਹਾਨੂੰ ਹਰ ਡਾਕਟਰ ਮਿਲੇਗਾ ਜੋ ਹਰ ਬਿਮਾਰੀ ਦਾ ਇਲਾਜ ਕਰ ਸਕਦਾ ਹੈ ਅਤੇ ਕੋਵਿਡ ਮਹਾਂਮਾਰੀ ਵਿੱਚ ਵੈਸੇ ਤਾਂ ਡਾਕਟਰਾਂ ਦੀ ਐਨੀ ਲੋੜਵੰਦ ਨਹੀਂ ਸੀ ਕਿਉਂਕਿ ਹਰ ਵਿਅਕਤੀ ਆਪਣਾ ਖਿਆਲ ਉਹ ਖੁਦ ਰੱਖ ਰਿਹਾ ਸੀਗਾ ਮਗਰ ਜੋ ਜ਼ਿਆਦਾ ਹੀ ਬਿਮਾਰ ਸੀਗਾ ਉਸ ਲਈ ਡਾਕਟਰ ਬਿਲਕੁਲ ਵਧੀਆ ਉਹਨਾਂ ਦਾ ਖਿਆਲ ਰੱਖ ਰਹੇ ਸਨ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਅਗਰ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਤਾਂ ਉਹ ਹਰ ਇੱਕ ਵਿਅਕਤੀ ਲਈ ਵਧੀਆ ਰਹੇਗਾ ਤਾਂ ਕਿ ਬਿਮਾਰੀ ਜ਼ਿਆਦਾ ਲੰਬੀ ਨਾ ਵਧੇ ਅਤੇ ਸ਼ੁਰੂ ਤੋਂ ਹੀ ਬਿਮਾਰੀ ਅਗਰ ਪਤਾ ਚੱਲ ਜਾਵੇ ਤਾਂ ਉਹਦੇ ਇਲਾਜ ਜਲਦੀ ਹੋ ਸਕਦਾ ਹੈ